ਖੇਡਾਂ ਜਿਹੜੀਆਂ ਇਹ ਇੱਕ ਜੀਵਨ ਦਾ ਜ਼ਰੂਰੀ ਅੰਗ ਨੇ ਖੇਡਾਂ ਬੱਚ ਅ ਸਰੀਰਕ ਅਤੇ ਮਾਨਸਿਕ ਤੌਰ 'ਤੇ ਬੰਦੇ ਨੂੰ ਬਹੁਤ ਮਜ਼ਬੂਤ ਕਰਦੀਆਂ ਨੇ ਸਰੀਰਕ ਤੌਰ 'ਤੇ ਤਾਂ ਜਿਹੜਾ ਫਿਜੀਕਲ ਫਿਟਨਸ ਹੈ ਉਹਦੇ ਤਾਂ ਖੇਡਾਂ ਨਾਲ ਰਹਿੰਦੀ ਹੋ ਰਹਿੰਦੀ ਹੈ ਮਾਨਸਿਕ ਤੌਰ 'ਤੇ ਵੀ ਬੰਦੇ ਨੂੰ ਜਿਹੜਾ ਬਹੁਤ ਖੇਡਾਂ ਮਜ਼ਬੂਤ ਕਰਦੀਆਂ ਹਨ ਬੰਦੇ ਨੂੰ ਖੇਡਾਂ ਜਰੂਰ ਖੇਡਣੀਆਂ ਚਾਹੀਦੀਆਂ ਹਨ ਅਤੇ ਬੱਚਿਆਂ ਨੂੰ ਵੀ ਖਿਡਾਉਣਾ ਚਾਹੀਦਾ ਹੈ ਭਾਰਤ ਦੇ ਵਿੱਚ ਜਿਹੜੇ ਖੇਡਾਂ ਦੇ ਕਰਾਉਣ ਲਈ ਛੋਟੇ ਪੱਧਰ ਤੋਂ ਹੀ ਛੋਟੇ ਛੋਟੇ ਟੂਰਨਾਮੈਂਟ ਛੋਟੇ ਬੱਚਿਆਂ ਨੂੰ ਕਰਾਉਣੇ ਚਾਹੀਦੇ ਹਨ ਜਿਸ ਤਰ੍ਹਾਂ ਕਿ ਸਾਲ ਵਿੱਚ ਇੱਕ ਵਾਰੀ ਹੀ ਟੂਰਨਾਮੈਂਟ ਹੁੰਦਾ ਉਹਦੇ ਨਾਲ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਚਾਰ ਦਿਨ ਬਾਅਦ ਫਿਰ ਬੱਚੇ ਉਹੀ ਗਲਤ ਕੰਮਾਂ 'ਚ ਪੈ ਜਾਂਦੇ ਨੇ ਅਤੇ ਨਸ਼ਿਆਂ ਵੱਲ ਨੂੰ ਤੁਰ ਜਾਂਦੇ ਨੇ ਇਹਨੂੰ ਰੋਕਣ ਲਈ ਸਾਨੂੰ ਹਰ ਤਿੰਨ ਮਹੀਨੇ ਬਾਅਦ ਹਰ ਮਹੀਨੇ ਤਿੰਨ ਮਹੀਨੇ ਬਾਅਦ ਛੇ ਮਹੀਨੇ ਬਾਅਦ ਅੱਡ ਅੱਡ ਕੰਪੀਟੀਸ਼ਨ ਕਰਾਉਣੇ ਚਾਹੀਦੇ ਹਨ ਵੈਸੇ ਤਾਂ ਪੰਜਾਬ ਸਰਕਾਰ ਨੇ ਇੱਕ ਨਵੀਂ ਕ ਪ ਖੇਡ ਨੀਤੀ ਲਿਆਂਦੀ ਹੈ ਖੇਡਾਂ ਪੰਜਾਬ ਦੀਆਂ ਪ੍ਰੋਗਰਾਮ ਤਹਿਤ ਇੱਕ ਖੇਡ ਮੇਲਾ ਕਰਾਇਆ ਗਿਆ ਸਾਲ ਪਰ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵੀ ਚਾਹੀਦੇ ਹਨ ਇੰਡੀਆ ਗੌਰਮੈਂਟ ਨੇ ਵੀ ਇੱਕ ਖੇਡੋ ਇੰਡੀਆ ਦਾ ਨਾਉਂ ਦਾ ਟੂਰਨਾਮੈਂਟ ਸ਼ੁਰੂ ਕਰਿਆ ਪਰ ਇਹ ਕੋਈ ਵਾਹਲੇ ਸਾਰਥਕ ਫਾਇਦਾ ਨਹੀਂ ਹੋ ਪਾ ਸਾਰਥਕ ਨਤੀਜੇ ਨਹੀਂ ਇਹਨਾਂ ਦੇ ਆਏ ਕਿਉਂਕਿ ਜਿਹੜਾ ਪੇਂਡੂ ਪੱਧਰ 'ਤੇ ਜਿ ਜਿਹੜੇ ਪਿੰਡਾਂ ਦੇ ਸਕੂਲ ਪੱਧਰ 'ਤੇ ਜਿਹੜੇ ਬੱਚੇ ਆ ਉਹਨਾਂ ਨੂੰ ਹੁਣ ਤੋਂ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਉਹਨਾਂ ਦੇ ਜਿਹੜਾ ਖਾਣ ਪੀਣ ਰਹਿਣ ਸਹਿਣ ਕੋਚਿੰਗ ਦਾ ਖਾਸ ਪ੍ਰਬੰਧ ਹੋਣਾ ਚਾਹੀਦਾ ਗਰੀਬ ਘਰ ਦੇ ਬੱਚੇ ਨੇ ਉਹਨਾਂ ਨੂੰ ਖੁਰਾਕ ਦਾ ਸਰਕਾਰ ਵੱਲੋਂ ਮਿਲਣੀ ਚਾਹੀਦੀ ਹੈ ਚੰਗਾ ਖੁਰਾਕ ਮਿਲੂਗੀ ਤਾਂ ਹੀ ਭਾਰਤ ਦਾ ਨਾਉਂ ਰੋਸ਼ਨ ਕਰਕੇ ਗੋਲਡ ਮੈਡਲ ਲੈ ਕੇ ਆਉਣਗੇ ਜੇਕਰ ਜਿਵੇਂ ਆਪਾਂ ਗੱਲ ਕਰੀਏ ਭਾਰਤ ਏਡਾ ਵੱਡਾ ਦੇਸ਼ ਹੈ ਪਰ ਸਾਡਾ ਗੋਲਡ ਮੈਡਲ ਕੋਈ ਏਸ਼ੀਆ ਓਲੰਪਿਕ ਦੇ ਵਿੱਚ ਬਹੁਤ ਘੱਟ ਆਉਂਦੇ ਨੇ ਅਤੇ ਜਿਹੜੇ ਹੋਰ ਛੋਟੇ ਛੋਟੇ ਮੁਲਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਗੋਲਡ ਮੈਡਲ ਆਉਂਦੇ ਨੇ ਜਿਹੜਾ ਖੇਡਾਂ ਦੇ ਉੱਤੇ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਿਹੜਾ ਸਾਡਾ ਜਵਾਨੀ ਹੈ ਉਹ ਨਸ਼ਿਆਂ ਤੋਂ ਵੀ ਬਚ ਸਕੇ ਅਤੇ ਇਸ ਚੰਗੇ ਪਾਸੇ ਲੱਗ ਸਕੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕੇ